ਅੱਜ ਕੱਲ੍ਹ ਡਿਜੀਟਲ ਕਲਾ ਦਾ ਹੀ ਬੋਲਬਾਲਾ ਹੈ ਸਾਰੇ ਪਾਸੇ ਕੰਪਿਊਟਰ ਨਾਲ ਕੰਮ ਕੀਤੇ ਜਾਂਦੇ ਆ ਤੁਸੀਂ ਕੁਝ ਵੀ ਸੋਚਦੇ ਹੋ ਜਾਂ ਕੁਝ ਵੀ ਮਨੋਰੰਜਨ ਲਈ ਦੇਖਣਾ ਚਾਹੁੰਦੇ ਹੋ ਤੁਸੀਂ ਆਪਣੇ ਕੰਪਿਊਟਰ ਦੇ ਇੱਕ ਸਰਚ ਦੇ ਨਾਲ ਹੀ ਤੁਹਾਨੂੰ ਸਾਰਾ ਕੁਛ ਮਿਲ ਜਾਂਦਾ ਹੈ ਜਦੋਂ ਦਾ ਇੰਟਰਨੈਟ ਦਾ ਬੋਲਬਾਲਾ ਹੋਇਆ ਹੈ ਹੁਣ ਤਾਂ ਹੋਰ ਵੀ ਆਸਾਨ ਹੋ ਗਿਆ ਹੈ ਪਹਿਲਾਂ ਤਾਂ ਅਸੀਂ ਆਪਣੇ ਮਨੋਰੰਜਨ ਲਈ ਪੱਤਰ ਲਿਖਦੇ ਸੀ ਸਟੇਜ ਦੇ ਡਰਾਮੇ ਦੇਖਦੇ ਸੀ ਖੁਦ ਨੂੰ ਮਨੋਰੰਜਨ ਕਰਨ ਲਈ ਕਈ ਪ੍ਰਕਾਰ ਦੀਆਂ ਖੇਡਾਂ ਵੀ ਖੇਡੀਆਂ ਜਾਂਦੀਆਂ ਸਨ ਜਿਸ ਨਾਲ ਕੀ ਸਰੀਰਕ ਕਸਰਤ ਵੀ ਹੁੰਦੀ ਸੀ ਪਰ ਹੁਣ ਸਿਰਫ ਡਿਜੀਟਲ ਕਲਾ ਦਾ ਹੀ ਬੋਲ ਬਾਲਾ ਹੈ ਹੁਣ ਲੋਕ ਇੱਕੋ ਸੋਫੇ 'ਤੇ ਬੈਠੇ ਹੀ ਸਾਰਾ ਕੁਝ ਕਰ ਲੈਂਦੇ ਆ ਸਰੀਰਕ ਕਸਰਤ ਵੀ ਨਹੀਂ ਹੁੰਦੀ ਨਾ ਹੀ ਦਿਮਾਗੀ ਵਿਕਾਸ ਹੋ ਰਿਹਾ ਹੈ ਕਿਉਂਕਿ ਸਾਨੂੰ ਇੱਕੋ ਸਰਚ ਵਿੱਚ ਹੀ ਸਭ ਕੁਛ ਪਤਾ ਲੱਗ ਜਾਂਦਾ ਹੈ ਅਤੇ ਸਾਨੂੰ ਕਿਸੇ ਕੋਈ ਵੀ ਮਿਹਨਤ ਵੀ ਨਹੀਂ ਕਰਨੀ ਪੈਂਦੀ ਇਸ ਲਈ ਜਿਹੜੀ ਡਿਜੀਟਲ ਕਲਾ ਹੈ ਮੇਰੇ ਅਨੁਸਾਰ ਉਹ ਸਾਨੂੰ ਆਲਸੀ ਬਣਾ ਰਹੀ ਹੈ